ਆਵਾਜਾਈ ਦੇ ਅੱਜ ਕੱਲ੍ਹ ਬਹੁਤ ਸਾਧਨ ਹਨ ਜਿਵੇਂ ਕਿ ਕਾਰ ਟਰੈਵਲਰ ਟੈਂਪੂ ਗੱਡੀਆਂ ਬੱਸਿਸ ਅਤੇ ਟਰੇਨ ਮੈਂ ਆਮ ਤੌਰ 'ਤੇ ਕਾਰ ਜਾਂ ਟਰੈਵਲਰ 'ਤੇ ਹੀ ਜਾਂਦਾ ਅਤੇ ਇੱਕ ਵਾਰ ਦੀ ਗੱਲ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਟਰੈਵਲਰ 'ਤੇ ਗਿਆ ਅਤੇ ਜ ਰਸਤੇ ਵਿੱਚ ਜਾਂਦੇ ਜਾਂਦੇ ਟਰੈਵਲਰ ਦਾ ਟਾਇਰ ਪੈਂਚਰ ਹੋ ਗਿਆ ਅਤੇ ਉੱਥੇ ਸਾਨੂੰ ਦੋ ਕਿਲੋਮੀਟਰ ਤੱਕ ਕੋਈ ਟਾਇਰ ਪੈਂਚਰ ਵਾਲਾ ਨਹੀਂ ਮਿਲਿਆ ਜਿਸ ਕਾਰਨ ਸਾਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਅਤੇ ਜਿੱਥੇ ਮੈਂ ਪਹੁੰਚਣਾ ਸੀਗਾ ਉੱਥੋਂ ਦੇ ਲੋਕਾਂ ਨੇ ਮੇਰਾ ਮਜ਼ਾਕ ਮਜ਼ਾਕ ਉਡਾਇਆ ਅਤੇ ਮੈਨੂੰ ਕਿਹਾ ਵੀ ਸਭ ਤੋਂ ਪਹਿਲਾਂ ਪਹੁੰਚਣ ਵਾਲਾ ਇਨਸਾਨ ਤਾਂ ਅੱਜ ਸਭ ਤੋਂ ਲੇਟ ਪਹੁੰਚਿਆ ਹੈ ਅਤੇ ਮੈਂ ਮ ਮੈਂ ਉੱਥੇ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ